ਜਦੋਂ ਮੈਂ ਦਸਵੀਂ ਜਮਾਤ ਦੇ ਪੇਪਰ ਦੇ ਕੇ ਵਿਹਲੀ ਹੋਈ ਤਾਂ ਮੈਂ ਆਪਣੇ ਮੰਮੀ ਕੋਲੋਂ ਬੁਣਾਈ ਅਤੇ ਸਿਲਾਈ ਸਿੱਖ ਲਈ ਮੇਰੀ ਮੰਮੀ ਕਹਿੰਦੇ ਹੁੰਦੇ ਸੀ ਕਿ ਇਹ ਸਾਰੀਆਂ ਚੀਜ਼ਾਂ ਕੁੜੀਆਂ ਨੂੰ ਆਉਣੀਆਂ ਚਾਹੀਦੀਆਂ ਤੇ ਫਿਰ ਉਨ੍ਹਾਂ ਨੇ ਪਹਿਲਾਂ ਮੈਨੂੰ ਬੁਣਾਈ ਸਿਖਾਈ ਮੈਂ ਉਨ੍ਹਾਂ ਕੋਲੋਂ ਸਿੱਖਿਆ ਸਾਰਾ ਕੁਛ ਪੁਛ ਪੁਛ ਕੇ ਬਣਾਉਂਦੀ ਹੁੰਦੀ ਸੀ ਪਹਿਲਾਂ ਅਤੇ ਇਸੇ ਤਰ੍ਹਾਂ ਮੈਂ ਸੂਟ ਵੀ ਸੀਣੇ ਸਿੱਖ ਲਏ ਜੋ ਵੀ ਜਿਹੜਾ ਵੀ ਕੰਮ ਮੈਨੂੰ ਕਹਿੰਦੇ ਸੀ ਸਿਲਾਈ ਦਾ ਮੈਂ ਉਹ ਵੀ ਕਰ ਲੈਂਦੀ ਸੀ ਅਤੇ ਬੁਣਾਈ ਦਾ ਵੀ ਮੈਂ ਕਾਫੀ ਜ਼ਿਆਦਾ ਸਵੈਟਰ ਬਣਾਏ ਮੇਰੇ ਮੰਮੀ ਮੈਨੂੰ ਜੈਂਟਸ ਸਵੈਟਰ ਵੀ ਬਣਾਉਣੇ ਸਿਖਾਏ ਬੱਚਿਆਂ ਦੇ ਸਵੈਟਰ ਵੀ ਬਣਾਉਣੇ ਸਿਖਾਏ ਅਤੇ ਮੈਂ ਅ ਉਨ੍ਹਾਂ ਨੇ ਮੈਨੂੰ ਕੋਈ ਨਾ ਕੋਈ ਉੱਨ ਲਿਆ ਕੇ ਦੇ ਦੇਣੀ ਅਤੇ ਮੈਂ ਦੇਖ ਕੇ ਡਿਜ਼ਾਈਨ ਵੀ ਪਾਉਣ ਲੱਗ ਗਈ ਮੇਰੇ ਮੰਮੀ ਬਹੁਤ ਖੁਸ਼ ਹੁੰਦੇ ਸੀ ਜਦੋਂ ਮੈਂ ਵਧੀਆ ਸਵੈਟਰ ਬਣਾ ਲੈਂਦੀ ਸੀ ਜਦੋਂ ਮੇਰੇ ਡੈਡੀ ਮੇਰੇ ਹੱਥ ਦਾ ਬਣਿਆ ਹੋਇਆ ਸਵੈਟਰ ਪਾ ਕੇ ਜਾਂਦੇ ਸੀ ਲੋਕ ਪੁੱਛਦੇ ਸੀ ਤਾਂ ਮੈਨੂੰ ਬੜੀ ਖੁਸ਼ੀ ਮਿਲਦੀ ਸੀ ਅਤੇ ਇਸ ਤਰ੍ਹਾਂ ਮੈਂ ਸਵੈਟਰ ਜਿਹੜੇ ਸੀ ਬਹੁਤ ਸੋਹਣੇ ਸੋਹਣੇ ਬਣਾਉਣ ਲੱਗ ਪਈ ਮੈਂ ਕਿਤਾਬਾਂ ਲਿਆਂਦੀਆਂ ਉੱਥੋਂ ਡਿਜ਼ਾਇਨ ਵੇਖਣੇ ਅਤੇ ਡਿਜ਼ਾਇਨ ਪਾ ਲੈਣੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਕਹਿਣਾ ਕਿ ਸਵੈਟਰ ਬਣਾ ਕੇ ਦੇ ਅਤੇ ਮੈਂ ਸਾਰਿਆਂ ਨੂੰ ਸਵੈਟਰ ਬਣਾ ਕੇ ਦਿੰਦੀ ਰਹੀ ਅਤੇ ਵਿਆਹ ਤੋਂ ਬਾਅਦ ਜਦੋਂ ਮੇਰੇ ਆਪਣੇ ਬੱਚੇ ਹੋਏ ਤਾਂ ਮੈਂ ਆਪਣੇ ਬੱਚਿਆਂ ਨੂੰ ਵੰਨ ਸੁਵੰਨੇ ਤਰ੍ਹਾਂ ਦੇ ਡਿਜ਼ਾਇਨਾਂ ਦੇ ਸਵੈਟਰ ਪਵਾਏ ਅਤੇ ਜਦੋਂ ਮੇਰੇ ਬੱਚੇ ਸਵੈਟਰ ਪਾ ਕੇ ਬਾਹਰ ਨਿਕਲਦੇ ਸੀ ਅਤੇ ਵੱਖਰੇ ਵੱਖਰੇ ਰੰਗਾਂ ਦੇ ਵੱਖਰੇ ਵੱਖਰੇ ਡਿਜ਼ਾਇਨਾਂ ਦੇ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ ਮੈਨੂੰ ਬਹੁਤ ਚੰਗਾ ਲੱਗਦਾ ਸੀ ਤਾਂ ਇਹ ਜਿਹੜਾ ਸੀਗਾ ਮੇਰਾ ਸ਼ੌਂਕ ਬਣ ਗਿਆ ਅਤੇ ਮੈਨੂੰ ਸਵੈਟਰ ਬਣਾਉਣੇ ਨੇਟਿੰਗ ਕਰਨੀ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ ਅਤੇ ਮੈਨੂੰ ਅੱਜ ਵੀ ਸਵ ਅ ਨੇਟਿੰਗ ਕਰਨੀ ਬਹੁਤ ਹੀ ਚੰਗੀ ਲੱਗਦੀ ਹੈ